ਸਤਿ ਸ਼੍ਰੀ ਅਕਾਲ ਅੱਜ ਸਾਡੇ ਘਰ ਰਿਸ਼ਤੇਦਾਰ ਆਏ ਹੋਏ ਸੀ ਇਸ ਕਰਕੇ ਅਸੀਂ ਸੋਚਿਆ ਵੀ ਚੱਲ ਸਾਰਿਆਂ ਦੇ ਚਾਚੇ ਤਾਏ ਦੇ ਬੱਚੇ ਹੈ ਅਤੇ ਮਾਮੇ ਦੇ ਬੱਚੇ ਆਏ ਹੋਏ ਸੀ ਅਤੇ ਅਸੀਂ ਸੋਚਿਆ ਵੀ ਚੱਲ ਅੱਜ ਨਾ ਮੂਵੀ ਵੇਖਦੇ ਹਾਂ ਮੂਵੀ ਦਾ ਅਸੀਂ ਪਲੈਨ ਬਣਾਇਆ ਅਤੇ ਮੂਵੀ ਵੇਖੀ ਆ ਅਤੇ ਮੂਵੀ ਵੇਖਣ ਅਸੀਂ ਬੈਠ ਗਏ ਵੀ ਜਿਸ ਕਰਕੇ ਇਹ ਇੱਕ ਯਾਦਗਾਰ ਪਲ ਬਣਜੇ ਅਤੇ ਫੇਰ ਅਸੀਂ ਸੋਚਿਆ ਵੀ ਮੂਵੀ ਵੇਖਦੇ ਸਮੇਂ ਅਸੀਂ ਪੋਪਕੋਨ ਅਤੇ ਕੋਲਡ ਡਰਿੰਕ ਪੀਵਾਂਗੇ ਅਤੇ ਇਹ ਇਹ ਕਰਕੇ ਇਹ ਅਸੀਂ ਇੱਕ ਯਾਦਗਾਰ ਪਲ ਬਣਾ ਸਕਾਂਗੇ ਅਤੇ ਮੂਵੀ ਦਾ ਅਨੰਦ ਲਵਾਂਗੇ ਪਰ ਇਸ ਕਰਕੇ ਅਸੀਂ ਇਹ ਸੋਚਿਆ ਬਾਅਦ ਵਿੱਚ ਮੈਂ ਇਹ ਗੱਲ ਸੋਚੀ ਵੀ ਯਾਰ ਮੂਵੀਆਂ ਤਾਂ ਇੱਕ ਤਰ੍ਹਾਂ ਦੀਆਂ ਵੇਖ ਵੇਖ ਕੇ ਮੈਂ ਥੱਕ ਚੁੱਕੀ ਹਾਂ ਮੈਂ ਹਰ ਹਰ ਵਾਰੀ ਇੱਕ ਮੂਵੀ ਵੇਖਦੀ ਰਹਿੰਦੀ ਹਾਂ ਕੋਮੇਡੀ ਕੋਮੇਡੀ ਕੋਮੇਡੀ ਜਾਂ ਰੋਮਾਂਚਕ ਰੋਮਾਂਚਕ ਰੋਮਾਂਚਕ ਇਹ ਕੋਈ ਮੈਂ ਵਧੀਆ ਮੂਵੀ ਵੇਖਣਾ ਚਾਹੁੰਦੀ ਹਾਂ ਜਿਸ ਕਰਕੇ ਮੇਰਾ ਨਾ ਮਤਲਬ ਕਿ ਮਨ ਖੁਸ਼ ਹੋ ਜਾਵੇ ਜਿਵੇਂ ਕਿ ਥ੍ਰਿਲਰ ਮੂਵੀ ਹੋ ਗਈ ਹੋਰ ਵੀ ਬਹੁਤ ਸਾਰੀਆਂ ਮਿਕਸ ਕਰਕੇ ਮੂਵੀਜ਼ ਮੈਂ ਬੂਲ ਬੁਲਈਆ ਖੇਲ ਖੇਲ ਮੇਂ ਵੇਖ ਕੇ ਨਾ ਥੋੜ੍ਹਾ ਜਿਹਾ ਮੇਰਾ ਮਨ ਇਸ ਚੀਜ਼ ਨੂੰ ਲੈ ਕੇ ਖਰਾਬ ਹੋ ਰਿਹਾ ਵੀ ਮੇਰਾ ਮਨ ਨਹੀਂ ਖੁਸ਼ ਹੁੰਦਾ ਜਦੋਂ ਮੈਂ ਆਹ ਮੂਵੀ ਵੇਖਦੀ ਮੈਂ ਕੁਛ ਵਧੀਆ ਜਿਹਾ ਦੇਖਣਾ ਪਸੰਦ ਕਰਨਾ ਚਾਹੁੰਦੀ ਹਾਂ ਵੀ ਜੋ ਮੇਰੇ ਮਨ ਨੂੰ ਵਧੀਆ ਲੱਗੇ ਅਤੇ ਮਨ ਨੂੰ ਮੇਰੇ ਭਾਵੇ ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਇਹੋ ਜਿਹੀ ਕੋਈ ਮੂਵੀ ਦੱਸੋ ਜੋ ਕਿ ਨੈੱਟਫਲਿਕਸ 'ਤੇ ਅਤੇ ਪ੍ਰਾਈਮ ਵੀਡੀਓ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਉਪਲਬਧ ਹੋਵੇ ਜੋ ਕਿ ਕਿਉਂਕਿ ਮੈਂ ਉਸ ਦਾ ਕੀ ਨਾਮ ਹੈ ਪੈਕ ਲਿੱਤਾ ਹੋਇਆ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਇਨ੍ਹਾਂ ਦੇ ਬਾਰੇ ਕੁਛ ਦੱਸੋ ਅਤੇ ਇਸ 'ਚ ਕੋਈ ਮੂਵੀ ਵਧੀਆ ਜਿਹੀ ਦੱਸੋ ਜੋ ਮੇਰੇ ਦੇਖਣ ਲਾਇਕ ਹੋਵੇ ਅਤੇ ਮੈਂ ਇਸਨੂੰ ਬਹੁਤ ਅਨੰਦ ਲਵਾਂ ਧੰਨਵਾਦ